ਤਾਰਿਆਂ ਬਾਰੇ ਜੇਕਰ ਦੇਖਿਆ ਜਾਵੇ ਤਾਂ ਕਾਫੀ ਇਤਿਹਾਸਿਕ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਹਨ ਜਿਵੇਂ ਕਿ ਸਾਡੇ ਖਾਸ ਕਰਕੇ ਸੱਭਿਆਚਾਰਕ ਪੰਜਾਬ ਵਿੱਚ ਮੰਨਿਆ ਜਾਂਦਾ ਹੈ ਵੀ ਇੱਕ ਬੋਦੀ ਵਾਲਾ ਤਾਰਾ ਵੀ ਹੁੰਦਾ ਸੀ ਇੱਕ ਰੱਬ ਦੀ ਮੰਜੀ ਕਹਿੰਦੇ ਹੁੰਦੇ ਸੀ ਉਹਦੇ ਵਿੱਚ ਸੱਤ ਤਾਰੇ ਹੁੰਦੇ ਸਨ ਜਿੰਨਾਂ ਦੇ ਵਿੱਚੋਂ ਚਾਰ ਪਾਵਿਆਂ ਨੂੰ ਮੰਜੀ ਦੇ ਪਾਵੇ ਦੱਸਦੇ ਹੁੰਦੇ ਸੀ ਵੀ ਰੱਬ ਦੀ ਮੰਜੀ ਆ ਇਹ 'ਤੇ ਤਿੰਨ ਜਾਣਿਆਂ ਨੂੰ ਇੱਕ ਨੂੰ ਚੋਰ ਇੱਕ ਨੂੰ ਪਹਿਰੇਦਾਰ ਅਤੇ ਇੱਕ ਨੂੰ ਕੁੱਤਾ ਦੱਸਦੇ ਹੁੰਦੇ ਸਨ ਵੀ ਇਸ ਅਸਲ ਦੇ ਵਿੱਚ ਇਹ ਸਾਇੰਸ ਮੁਤਾਬਕ ਦੇਖਿਆ ਜਾਵੇ ਤਾਂ ਇਸ ਨੂੰ ਸਪਤ ਰਿਸ਼ੀ ਤਾਰੇ ਕਹਿੰਦੇ ਸੀ ਇਹ ਅੱਜ ਵੀ ਤੁਸੀਂ ਦੇਖ ਲਿਓ ਅਸਮਾਨ ਦੇ ਵਿੱਚ ਤੁਹਾਨੂੰ ਉਸੇ ਤਰ੍ਹਾਂ ਨਜ਼ਰ ਆ ਜਾਣਗੇ ਜਦੋਂ ਤਾਰੇ ਚੜ੍ਹਦੇ ਹਨ ਅਤੇ ਪਰ ਪਿੰਡਾਂ ਦੇ ਵਿੱਚ ਇੱਕ ਇਤਿਹਾਸ ਬਣਿਆ ਲਗਾ ਲਓ ਜਾਂ ਕੋਈ ਕਹਾਵਤਾਂ ਕਹਿ ਲੈਂਦੇ ਹਾਂ ਆਪਾਂ ਇੱਦਾਂ ਦਾ ਕੁਝ ਚੱਲਦਾ ਰਹਿੰਦਾ ਉਹ ਪਿੰਡਾਂ ਦੇ ਵਿੱਚ ਬਜ਼ੁਰਗ ਛੋਟੇ ਬੱਚਿਆਂ ਨੂੰ ਉਹਨਾਂ ਦੇ ਬਾਤਾਂ ਸੁਣਾਉਂਦੇ ਹੁੰਦੇ ਸਨ ਵੀ ਉਹ ਰੱਬ ਦੀ ਮੰਜੀ ਆ ਉਹ ਪਹਿਰੇਦਾਰ ਖੜਾ ਉਹ ਚੋਰ ਆ ਚੋਰੀ ਕਰਨ ਆ ਰਿਹਾ ਉਹ ਕੁੱਤਾ ਖੜਾ ਇਹ ਰੱਬ ਦੇ ਚਾਰ ਪਾਵੇ ਨੇ ਇਹਦੇ ਥੱਲੇ ਉਹਦਾ ਪਿਆ ਹੁੰਦਾ ਸੋਨਾ ਪਿਆ ਸੀ ਉਹ ਚੱਕਣ ਆਏ ਸੀ ਮਤਲਬ ਇਹੋ ਜਿਹੀਆਂ ਕੁਝ ਕਹਾਣੀਆਂ ਪੰਜਾਬ ਦੇ ਵਿੱਚ ਆਮ ਪ੍ਰਚੱਲਿਤ ਹਨ